ਹਾਂਜੀ ਭਾਅ ਜੀ ਮੈਂ ਨਾ ਤੁਹਾਡੀ ਕੈਬ ਕੀਤੀ ਸੀ ਚੰਡੀਗੜ੍ਹ ਤੋਂ ਖਰੜ ਆਉਣ ਲਈ ਅਤੇ ਤੁਸੀਂ ਮੈਨੂੰ ਪੰਜ ਮਿੰਟ ਪਹਿਲਾਂ ਖਰੜ ਉਤਾਰ ਕੇ ਗਏ ਹੋ ਮੈਂ ਓਲਾ ਤੋਂ ਤੁਹਾਡੀ ਕੈਬ ਬੁੱਕ ਕੀਤੀ ਸੀ ਅਤੇ ਮੇਰੇ ਕੋਲ ਕਾਫੀ ਸਮਾਨ ਸੀ ਮੈਂ ਆਪਣਾ ਸਾਰਾ ਸਮਾਨ ਚੁੱਕ ਲਿਆ ਪਰ ਮੈਂ ਆਪਣਾ ਇੱਕ ਬੈਗ ਭੁੱਲ ਗਈ ਉਹਦੇ ਵਿੱਚ ਮੇਰੇ ਜ਼ਰੂਰੀ ਡਾਕੂਮੈਂਟ ਸੀਗੇ ਅਤੇ ਮੈਂ ਖਰੜ ਜਿੱਥੇ ਤੁਸੀਂ ਮੈਨੂੰ ਉਤਾਰ ਕੇ ਗਏ ਸੀ ਮੈਂ ਉੱਥੇ ਹੀ ਖੜ੍ਹੀ ਹਾਂ ਅਤੇ ਮੈਨੂੰ ਉਹ ਜ਼ਰੂਰੀ ਹੁਣੇ ਹੀ ਚਾਹੀਦਾ ਤਾਂ ਤੁਸੀਂ ਪਲੀਜ਼ ਵਾਪਿਸ ਆ ਕੇ ਮੇਰਾ ਉਹ ਸਮਾਨ ਮੈਨੂੰ ਵਾਪਸ ਕਰਕੇ ਜਾਓ ਥੈਂਕ ਯੂ ਜੀ